ਹਾਂਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਤੁਸੀਂ ਆਪਣਾ ਸੁਣਾਓ ਕਿੱਦਾਂ ਕਿੱਦਾਂ ਕਿੱਧਰ ਰਹਿੰਦੇ ਹੋ ਅੱਜ ਕੱਲ੍ਹ ਵੀਜ਼ੀ ਕਦੀ ਆਉਂਦੇ ਜਾਂਦੇ ਹੀ ਨਹੀਂ ਅੱਛਾ ਅੱਛਾ ਫਿਰ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਾਂ ਇਹਦੇ ਇੱਦਾਂ ਹੈ ਨਾ ਕਿ ਇੱਕ ਤਾਂ ਟਾਈਮ ਬਹੁਤ ਵੇ ਹੋ ਜਾਂਦਾ ਹੈ ਨਾ ਕਿ ਕਿਉਂਕਿ ਦਿਨ ਵੀ ਬਹੁਤ ਛੋਟੇ ਹੋ ਚੁੱਕੇ ਆ ਇੱਕ ਜਲੰਧਰ ਆਪਣੇ ਦੇ ਵਿੱਚ ਟਰੈਫਿਕ ਹੀ ਇੰਨਾ ਆ ਕਿ ਬੰਦਾ ਆਵੇ ਵੀ ਕੀ ਅਤੇ ਉਹ ਰਸਤੇ 'ਚ ਹੀ ਫਸਿਆ ਰਹਿੰਦਾ ਆ ਹਾਂਜੀ ਹਾਂਜੀ ਅੱਛਾ ਅੱਛਾ ਹਾਂ ਉਹ ਵੀ ਟਾਈਮ ਵੇਸਟ ਹੋ ਜਾਂਦਾ ਨਾ ਫਿਰ ਬੰਦੇ ਦਾ ਹਾਂ ਇਹ ਤਾਂ ਇਹ ਮੁਸ਼ਕਿਲ ਬਹੁਤ ਆਉਂਦੀ ਅਸਲ ਵਿੱਚ ਪਤਾ ਕੀ ਆ ਇੱਕ ਟਰੈਫਿਕ ਵੀ ਜਲੰਧਰ ਵਿੱਚ ਤਾਂ ਜ਼ਿਆਦਾ ਹੋ ਰਿਹਾ ਕਿ ਅੱਜ ਕੱਲ੍ਹ ਕੋਈ ਕਿਸੇ ਦੀ ਕੰਪਨੀ ਤਾਂ ਲੈਣਾ ਹੀ ਨਹੀ ਚਾਹੁੰਦਾ ਇੱਕ ਭਰ ਇੱਕ ਘਰ 'ਚ ਦੋ ਬੰਦੇ ਜਾ ਰਿਹਾ ਤਾਂ ਹਰ ਇੱਕ ਬੰਦਾ ਕਹਿੰਦਾ ਕਿ ਮੇਰੇ ਕੋਲ ਆਪਣਾ ਵਹੀਕਲ ਹੋਵੇ ਉਹਦੇ ਕਰਕੇ ਜੇ ਆਪਾਂ ਹੁਣ ਇਹ ਇਹੀ ਪ੍ਰੋਬਲਮ ਹੈ ਨਾ ਕੇ ਜੇ ਜੇ ਆਪਾਂ ਇੱਕ ਘਰ 'ਚੋਂ ਚਾਰ ਬੰਦੇ ਪਰਸਨ ਜਾਂ ਚਾਰ ਜੀਅ ਜਾ ਰਹੇ ਹਾਂ ਤਾਂ ਚਾਰੇ ਹੀ ਆਪਣਾ ਆਪਣਾ ਸਾਧਨ ਲੈ ਕੇ ਜਾਵਾਂਗੇ ਜਦੋਂ ਚਾਰੇ ਉਹ ਟਰੈਫਿਕ ਜਿਹੜਾ ਉਹ ਵਧੀ ਪਈ ਸੜਕਾਂ 'ਤੇ ਉਹਨੇ ਘਟਨਾ ਤਾਂ ਹੈ ਨਹੀਂ ਹੈਗਾ ਪਰ ਉਹ ਇਹ ਨਹੀ ਸੋ ਮਤਲਬ ਨੋਰਮਲ ਜਨਤਾ ਇਹ ਨਹੀਂ ਸੋਚਦੀ ਕਿ ਇਹਦੇ ਨਾਲ ਜਿਹੜਾ ਟਾਈਮ ਜ਼ਿਆਦਾ ਵੇਸਟ ਹੋ ਰਿਹਾ ਸਾਡਾ ਕਿਉਂਕਿ ਹੁਣ ਇੱਦਾਂ ਵੀ ਤੁਹਾਡੇ ਵੀ ਵਿਆਹ ਦਾ ਸੀਜ਼ਨ ਕਰਕੇ ਫਿਰ ਤੁਹਾਨੂੰ ਜਾਣਾ ਵੀ ਡੇਲੀ ਪੈਂਦਾ ਹੋਣਾ ਕਿਉਂਕਿ ਸ਼ੋਪਿੰਗ ਹੀ ਨਹੀਂ ਮੁੱਕਦੀ ਹੁੰਦੀ ਵਿਆਹ ਤੱਕ ਤਾਂ ਹੈ ਨਾ ਇੱਧਰ ਸਾਡੇ ਏਰੀਏ 'ਚ ਵੀ ਇੰਨਾ ਰੋਡ ਪ੍ਰੋਪਰ ਜਾਮ ਰਹਿੰਦੇ ਆ ਜਦੋਂ ਨਿਕਲੋਂ ਦਸ ਮਿੰਟ ਤਾਂ ਸਾਨੂੰ ਮੇਨ ਰੋਡ ਤੱਕ ਜਾਣ ਨੂੰ ਹੀ ਲੱਗ ਜਾਂਦੇ ਆ ਜਦੋਂ ਕਿ ਸਿਰਫ ਇੱਕ ਦੋ ਕਿਲੋਮੀਟਰ ਦਾ ਹੀ ਇੱਕ ਕਿਲੋਮੀਟਰ ਨੀਅਰ ਅਬਊਟ ਸਾਡੇ ਕੋਲੋਂ ਇੱਕ ਤਰਫਾ ਹੈਗਾ ਆ ਜਿਹੜਾ ਰੋਡ ਆ ਪਰ ਗੱਲ ਇਹ ਆ ਕਿ ਉੱਪਰ ਟਰੈਫਿਕ ਹੀ ਇੰਨਾ ਜ਼ਿਆਦਾ ਹੁੰਦਾ ਆ ਕਿ ਅੱਗੇ ਲੰਘਿਆ ਹੀ ਨਹੀਂ ਜਾਂਦਾ ਵਨ ਵੇਅ ਰੋਡ ਹੈ ਆ ਲੋਕਾਂ ਨੇ ਟੂ ਵੇਅ ਬਣਾ ਦਿੱਤਾ ਆ ਹਾਂ ਦੋ ਕਿਉਂਕਿ ਹੁਣ ਟਰੈਫਿਕ ਜ਼ਿਆਦਾ ਆ ਸੜਕ ਸੜਕਾਂ 'ਤੇ ਬਸਾਂ ਕਾਰਾਂ ਗੱਡੀਆਂ ਸਕੂਟਰੀਆਂ ਅੱਜ ਕੱਲ੍ਹ ਤਾਂ ਵਧ ਹੀ ਇੰਨਾ ਜਾ ਚੁੱਕੀਆ ਹੈ ਕਿ ਕਰੋਸ ਕਰਨਾ ਮੁਸ਼ਕਿਲ ਹੋ ਰਿਹਾ ਵੱਡੇ ਨਹੀਂ ਹੈਗੇ ਨਾ ਰੋਡ ਹਾਂ ਉਹ ਜਿੱਦਾਂ ਰੋਡ ਫਲਾਈਓਵਰਾਂ 'ਤੇ ਉਹਨਾਂ ਨੇ ਜ਼ਿਆਦਾ ਜ਼ੋਰ ਲਗਾ ਦਿੱਤਾ ਜਿਹਨਾਂ ਨੇ ਰੋਡ ਜਿਹੜੇ ਰੋਡ ਲੋਕਾਂ ਨੇ ਕਵਰ ਕਰ ਲਏ ਆਪਣੇ ਘਰਾਂ 'ਚ ਦੁਕਾਨਾਂ 'ਚ ਉਹਨਾਂ ਨੂੰ ਉਹਨਾਂ ਨੇ ਦੇਖਿਆ ਹੀ ਨਹੀਂ ਹੁਣ ਇਹਦੇ ਕਰਕੇ ਫਿਰ ਹਾਂ ਕਿਉਂਕਿ ਇੱਦਾਂ ਆ ਨਾ ਕਿ ਜਿਹੜਾ ਜਿੱਦਾਂ ਲੁਧਿਆਣੇ ਨੂੰ ਜਾਂਦਾ ਉਹੀ ਕਰੋਸ ਕਰ ਹੁੰਦਾ ਜਿਹਨਾਂ ਨੇ ਇੱਧਰੋਂ ਹੁਸ਼ਿਆਰਪੁਰ ਰੋਡ ਤੋਂ ਆਉਣਾ ਡਿਸਟਰਿਕ ਦੇ ਅੰਦਰ ਜਾਣਾ ਉਹਨਾਂ ਲਈ ਤਾਂ ਬਹੁਤ ਮੁਸ਼ਕਿਲ ਆ ਰਹੀ ਆ ਕਿਉਂਕਿ ਬਹੁਤ ਕੰਜਸਟਡ ਹੋ ਜਾਂਦਾ ਨਾ ਉੱਥੋਂ ਟਰਨ ਨਹੀਂ ਕਰ ਹੁੰਦਾ ਬਹੁਤ ਜੂ ਜਾ ਕੇ ਯੂਟਰਨ ਹੁੰਦਾ ਸੜਕਾਂ 'ਤੇ ਮੁਸ਼ਕਿਲ ਤਾਂ ਬਹੁਤ ਆ ਅਤੇ ਫਿਰ ਵੀ ਮਤਲਬ ਇੱਦਾਂ ਆ ਕਿ ਜਾਣਾ ਤਾਂ ਪੈਂਦਾ ਹੀ ਆ ਜਿੱਥੇ ਜਾਣਾ ਉੱਥੇ ਤਾਂ ਜਾਣਾ ਹੀ ਆ ਨਾ ਅਤੇ ਉਹ ਆਪਾਂ ਇੱਦਾਂ ਵੀ ਨਹੀਂ ਹੈਗਾ ਕਿ ਆਪਾਂ ਤਿਆਰੀ ਨਾ ਕਰਾਂਗੇ ਤਿਆਰੀ ਕਰਨ ਲਈ ਸ਼ਹਿਰ ਤਾਂ ਜਾਣਾ ਹੀ ਪੈਣਾ ਸਮਾਨ ਵੀ ਖਰੀਦਣਾ ਪੈਣਾ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਤਾਂ ਵੇਸਟ ਹੋ ਜਾਂਦਾ ਸਾਡੇ ਰੋਕੇ ਦੇ ਵਿੱਚ ਹੀ ਹਾਂਜੀ ਨਹੀਂ ਨਹੀਂ ਟਾਈਮ ਤਾਂ ਜ਼ਰੂਰ ਕੱਢਿਓ ਮੈਂ ਸੋਚਦੀ ਸੀ ਚਲੋ ਕਿਸੇ ਦਿਨ ਬੈਠ ਕੇ ਗੱਪ ਛਪ ਹੋ ਜਾਂਦੀ ਨਾਲੇ ਚਾਹ ਪਾਣੀ ਹੋ ਜਾਂਦਾ ਆ ਹਾਂਜੀ ਹਾਂਜੀ ਹੋਰ ਤਿਆਰੀ ਕਿੱਥੇ ਕੁ ਪਹੁੰਚ ਗਈ ਹੈ ਅੱਛਾ ਅੱਛਾ ਹਾਂ ਅਤੇ ਇੱਕ ਇੱਦਾਂ ਨਾ ਵੀ ਜ਼ਿਆਦਾਤਰ ਸਕੂਲ ਵਗੈਰਾ ਵੀ ਖੁੱਲ੍ਹ ਗਏ ਉਹਦੇ ਕਰਕੇ ਸਕੂਲ ਬੱਸਾਂ 'ਚ ਹੀ ਜਾਣ ਲੱਗ ਪਏ ਸਾਰੇ ਹੈ ਨਾ ਸਕੂਲ ਬੱਸਾਂ ਦਾ ਵੀ ਮਾਹੌਲ ਤੁਸੀਂ ਸਵੇਰੇ ਸਵੇਰੇ ਦੇਖਿਓ ਕਿੱਦਾਂ ਰੋਡ ਭਰੇ ਹੀ ਜਾਂਦੇ ਹੁੰਦੇ ਹੈ ਕਿਉਂਕਿ ਅੱਗੇ ਪਹਿਲਾਂ ਹੁੰਦਾ ਸੀ ਕਿ ਬੱਚੇ ਜਿਹੜੇ ਹੈ ਸਾਈਕਲਾਂ 'ਤੇ ਚਲੇ ਜਾਂਦੇ ਸੀਗੇ ਹੁਣ ਪੇਰੈਂਟਸ ਵੀ ਬੱਚਿਆਂ ਨੂੰ ਇੰਨੀਆਂ ਕੁ ਸਹੂਲਤਾਂ ਦਿੰਦੇ ਆ ਕਿ ਕਹਿੰਦੇ ਸਾਡੇ ਘਰੋਂ ਹੀ ਬੱਚੇ ਨੂੰ ਤੁਸੀਂ ਬੱਸ 'ਚ ਬਿਠਾ ਕੇ ਲੈ ਜਾਓ ਇਹ ਸਾਰਾ ਟਰੈਫਿਕ ਦਾ ਹੀ ਕਾਰਨ ਬਣ ਰਿਹਾ ਤਾਂ ਕਰਕੇ ਫਿਰ ਹਾਂ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਹੀ ਸਾਰਿਆਂ ਨੂੰ ਇਹ ਹੈ ਕਿ ਅਸੀਂ ਵੱਧ ਆਪਣਾ ਜੇ ਸਾਡੇ ਕੋਲ ਕੋਈ ਸਾਧਨ ਵੀ ਹੈ ਅਸੀਂ ਉਹ 'ਤੇ ਹੀ ਜਾਈਏ ਸਾਨੂੰ ਵੀ ਲੋਕ ਦੇਖਣ ਵੀ ਹਾਂ ਆਹ ਵੀ ਇਹਨਾਂ ਕੋਲ ਹੈਗਾ ਤਾਂ ਵਾਕਈ ਵਰਤ ਰਹੇ ਹੈ ਪਬਲਿਕ ਤਾਂ ਵਰਤ ਕੇ ਹੀ ਨਹੀਂ ਰਾਜ਼ੀ ਹੈਗਾ ਕਿਉਂਕਿ ਪਬਲਕਿ ਟਰਾਂਸਪੋਰਟ ਦੇ ਵਿੱਚ ਉਹ ਆ ਨਾ ਕਿ ਲੇਡੀਜ਼ ਨੂੰ ਸਹੂਲਤਾਂ ਜ਼ਿਆਦਾ ਆ ਅਤੇ ਪਰ ਲੇਡੀਜ਼ ਨੇ ਆਪਣਾ ਟਾਈਮ ਹੀ ਵਾਧੂ ਖਰਾਬ ਕਰਕੇ ਆਉਣਾ ਆ ਅਤੇ ਜੇ ਬੰਦਿਆਂ ਨੂੰ ਜ਼ਰੂਰਤ ਅਤੇ ਬੰਦਿਆਂ ਨੂੰ ਸਰਕਾਰ ਦਿੰਦੀ ਕੁਛ ਨਹੀਂ ਹੈਗੀ ਹਾਲੇ ਤਾਂ ਇਹ ਵੀ ਹੈ ਨਾ ਬੱਸਾਂ ਤਾਂ ਇੰਨੀਆਂ ਓਵਰ ਕਰਾਊਡਡ ਹੋਈਆਂ ਐ ਹੁੰਦੀਆਂ ਕਿ ਉਹਨਾਂ ਵਿੱਚ ਜਾਣਾ ਹੀ ਮੁਸ਼ਕਿਲ ਹੋਇਆ ਹੁੰਦਾ ਹੁਣ ਅਸਲ ਵਿੱਚ ਪਤਾ ਕੀ ਆ ਜਿੱਦਾਂ ਮੋਡਰਨ ਜ਼ਮਾਨਾ ਸਾਰੇ ਇੱਕ ਆਪਣੇ ਘਰ ਤੋਂ ਘਰ ਦੂਜੇ ਥਾਂ ਕਮਾਉਣ ਜਾਂਦੇ ਆ ਅੱਗੇ ਹੁੰਦਾ ਸੀ ਇੱਕ ਦੋ ਪਰਸਨ ਘਰੋਂ ਜਾਂਦੇ ਹੁੰਦੇ ਸੀ ਹੁਣ ਤਾਂ ਸਾਰੇ ਹੀ ਜਾਂਦੇ ਆ ਉਹ ਵੀ ਇੱਦਾਂ ਜਿੰਨਾ ਕੁ ਜਿੰਨੇ ਜੇ ਕੋਈ ਬਸ 'ਚ ਚਲਾ ਜਾਂਦਾ ਕੋਈ ਸਕੂਟਰ 'ਤੇ ਕੋਈ ਗੱਡੀ 'ਤੇ ਉਹਦੇ ਕਰਕੇ ਫਿਰ ਬਹੁਤ ਮੁਸ਼ਕਿਲ ਹੋ ਰਿਹਾ ਰੋਡ ਤੁਸੀਂ ਦੇਖੋ ਮਤਲਬ ਤਾਂ ਅਸੀਂ ਕਰੋਸ ਨਹੀਂ ਕਰ ਸਕਦੇ ਜੈਬਰਾ ਕਰੋਸਿੰਗ 'ਤੇ ਕਰੋਸ ਕਰਨ ਲਈ ਵੀ ਤੁਹਾਨੂੰ ਦਸ ਮਿੰਟ ਵੇਟ ਕਰਨੀ ਪਊਗੀ ਗੱਲ ਤਾਂ ਇਹ ਨਾ ਟੋਏ ਟਿੱਬੇ ਵੀ ਬਹੁਤ ਹੈ ਆ ਮਤਲਬ ਠੀਕ ਆ ਕੋਈ ਨਹੀਂ ਮਾਰਿਓ ਜ਼ਰੂਰ ਚੱਕਰ ਕਿਸੇ ਦਿਨ ਟੈਮ ਕੱਢ ਕੇ ਬੈਠਾਂਗੇ ਦੋ ਘੰਟੇ ਹਾਂਜੀ ਹਾਂਜੀ ਠੀਕ ਓਕੇ